ਹਾਂਜੀ ਮੈਂ ਆਟੋਮੈਟਿਕ ਅਨੁਵਾਦ ਅਤੇ ਗੂਗਲ ਮੈਪਸ ਦੀ ਵਰਤੋਂ ਅਕਸਰ ਕਰਦੀ ਰਹਿੰਦੀ ਹਾਂ ਅਤੇ ਵਧੀਆ ਮੇਰਾ ਜਿਹੜਾ ਤਜਰਬਾ ਵਧੀਆ ਰਹਿੰਦਾ ਆ ਐਕਸਪੀਰੀਅੰਸ ਵਧੀਆ ਆ ਸਹੀ ਹੁੰਦੇ ਨੇ ਕਾਫੀ ਸਹੀ ਹੁੰਦੇ ਨੇ ਕਦੇ ਹੁੰਦਾ ਕਿ ਕੋਈ ਰੋਡ ਕੋਈ ਬਾਏ ਚਾਂਸ ਇਮੀਡੀਏਟ ਕੋਈ ਖਰਾਬ ਹੋ ਗਿਆ ਜਾਂ ਕੁਛ ਤਾਂ ਉਹ ਨਹੀਂ ਸ਼ੋਅ ਕਰਦਾ ਅਦਰਵਾਈਜ਼ ਅਪਡੇਟ ਹੁੰਦਾ ਆ ਹਮੇਸ਼ਾਂ ਗੂਗਲ ਮੈਕਸ ਬਹੁਤ ਵਧੀਆ ਕਦੇ ਵੀ ਕਿਸੇ ਨਵੀਂ ਜਗ੍ਹਾ 'ਤੇ ਜਾਓ ਅਤੇ ਤੁਹਾਨੂੰ ਬਹੁਤ ਆਸਾਨੀ ਨਾਲ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਅਤੇ ਆਟੋਮੈਟਿਕ ਅਨੁਵਾਦ ਵੀ ਬਹੁਤ ਵਧੀਆ ਆ ਕਈ ਵਾਰੀ ਕੋਈ ਅੰਗਰੇਜ਼ੀ ਦਾ ਜਿਹੜੀ ਨਿਊਜ਼ ਹੁੰਦੀ ਆ ਪੰਜਾਬੀ 'ਚ ਕਨਵਰਟ ਕਰਨੀ ਹੁੰਦੀ ਹੈ ਅਤੇ ਸਾਨੂੰ ਬਹੁਤ ਸੌਖਾ ਰਹਿੰਦਾ ਆ ਅਤੇ ਇਸ ਲਈ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਲਾਹੇਵੰਦ ਨੇ